ਮੈਂ ਬਚਪਨ ਤੋਂ ਹੀ ਗਾਉਣ ਵੱਲ ਬਹੁਤ ਰੁਚਿਤ ਰਿਹਾ ਹਾਂ ਮੈਂ ਗਾਉਣ ਦੇ ਲਈ ਸਪੈਸ਼ਲ ਆਪਣੇ ਗੁਰੂ ਜੀ ਤੋਂ ਤਾਲੀਮ ਲਈ ਹੈ ਮੈਂ ਸੰਗੀਤ ਸਿੱਖਿਆ ਹੈ ਮੈਂ ਉਹਨਾਂ ਕੋਲ ਬੈਠ ਕੇ ਰਿਆਜ਼ ਕੀਤਾ ਹੈ ਉਸ ਰਿਆਜ਼ ਨੂੰ ਮੈਂ ਘਰ ਆ ਕੇ ਹਰਮੋਨੀਅਮ 'ਤੇ ਪੂਰੀ ਤਰ੍ਹਾਂ ਨਾਲ ਕੱਢਦਾ ਸੀ ਉਹਦੇ ਨਾਲ ਮੈਂ ਆਪਣੇ ਆਪ ਨੂੰ ਪਰਫੈਕਟ ਕਰਨ ਦੀ ਕੋਸ਼ਿਸ਼ ਕਰਦਾ ਸੀ ਸੋ ਸੰਗੀਤ ਮੇਰੀ ਜ਼ਿੰਦਗੀ ਹੈ ਸੰਗੀਤ ਤੋਂ ਬਿਨਾਂ ਮੈਂ ਕੁਝ ਵੀ ਨਹੀਂ ਹਾਂ ਮੈਂ ਉਹਨੂੰ ਅੱਗੇ ਅੱਗੇ ਹੋਰ ਪ੍ਰਫੁਲਿਤ ਕਰਨ ਲਈ ਕੰਮ ਕਰਦਾ ਹਾਂ ਮੈਂ ਆਪਣੇ ਆਪ ਨੂੰ ਹੋਰ ਪਰਫੈਕਟ ਕਰਨ ਲਈ ਰੋਜ਼ ਰਿਆਜ਼ ਕਰਦਾ ਹਾਂ ਰੋਜ਼ ਉਸ ਦੇ ਲਈ ਨਵੀਆਂ ਧੁਨਾਂ ਸੋਚਦਾ ਹਾਂ ਰੋਜ਼ ਉਹਦੇ ਲਈ ਨਵੇਂ ਗੀਤ ਲੱਭਦਾ ਹਾਂ ਨੋਜ ਰੋਜ਼ ਉਹਨਾਂ ਲਈ ਨਵੀਆਂ ਧੁਨਾਂ ਤਿਆਰ ਕਰਦਾ ਹਾਂ ਮੈਂ ਆਪਣੇ ਗੀਤਾਂ ਨੂੰ ਰਿਕੋਡਿੰਗ ਵੱਲ ਵੀ ਲੈ ਕੇ ਜਾਂਦਾ ਹੈ ਮੈਂ ਆਪਣੇ ਗੀਤਾਂ ਦੇ ਨਾਲ ਜਿਉਂਦਾ ਹਾਂ ਮੈਂ ਆਪਣੇ ਗੀਤਾਂ ਨਾਲ ਤੁਰਦਾ ਹਾਂ ਖੇਤਾਂ ਵਿੱਚ ਹੋਵਾਂ ਘਰ ਵਿੱਚ ਹੋਵਾਂ ਜਾਂ ਕਿਤੇ ਰਸਤੇ ਵਿੱਚ ਘੁੰਮ ਰਿਹਾ ਹੋਵਾਂ ਮੈਨੂੰ ਗੀਤ ਗਾਉਣਾ ਚੰਗਾ ਲੱਗਦਾ ਹੈ ਇਹ ਮੇਰੀ ਜ਼ਿੰਦਗੀ ਹੈ ਸੋ ਮੈਂ ਇਸ ਹੁਨਰ ਨੂੰ ਆਪਣੀ ਜ਼ਿੰਦਗੀ ਦੇ ਆਖਰੀ ਵਕਤ ਤੱਕ ਆਪਣੇ ਨਾਲ ਲੈ ਕੇ ਚੱਲਣਾ ਚਾਹਵਾਂਗਾ